ਹਾਂਜੀ ਛੋਟੇ ਹੁੰਦੇ ਜਦੋਂ ਘਰ ਦੇ ਵਿੱਚ ਦੇਖਦੇ ਹੁੰਦੇ ਸੀ ਤਾਂ ਇੱਕ ਤਿਉਹਾਰ ਆਉਂਦਾ ਸੀ ਦੁਸਹਿਰੇ ਵੇਲੇ ਉਦੋਂ ਇੱਕ ਸਾਂਝੀ ਮਾਤਾ ਦੀ ਜਿਹੜੀ ਹੈਗੀ ਮੂਰਤੀਆਂ ਬਣਾਉਂਦੇ ਹੁੰਦੇ ਮਿੱਟੀ ਨਾਲ਼ ਜਿਹੜੇ ਹੈਗੇ ਉਹਦਾ ਫੇਸ ਬਣਾਉਣਾ ਜਿਹੜਾ ਹੈ ਉਹਦੇ ਚੰਦ ਤਾਰੇ ਜਾਂ ਕੁਛ ਇੱਦਾਂ ਦਾ ਉਹਦਾ ਬਣਾਉਣਾ ਸਾਰਾ ਕੁਛ ਕ੍ਰੀਏਟ ਕਰਨਾ ਤਾਂ ਉਸ ਸਮੇਂ ਜਿਹੜਾ ਹੈ ਉਹਦੀ ਪੂਜਾ ਕੀਤੀ ਜਾਂਦੀ ਬਾਅਦ ਦੇ ਵਿੱਚ ਜਿਹੜੀ ਹੈਗੀ ਆ ਉਸ ਨੂੰ ਜਿਹੜਾ ਹੈ ਗੋਹੇ ਦੇ ਉੱਪਰ ਲਿਪ ਕੇ ਉਹਨੂੰ ਲਾਇਆ ਜਾਂਦਾ ਸਾਰੀ ਨੂੰ ਕ੍ਰੀਏਟ ਕੀਤਾ ਜਾਂਦਾ ਸਾਂਝੀ ਮਾਤਾ ਦੀ ਪੂਜਾ ਕੀਤੀ ਜਾਂਦੀ ਬਾਅਦ ਵਿੱਚ ਦੁਸਹਿਰੇ ਵਾਲੇ ਦਿਨ ਜਿਹੜਾ ਹੈ ਉਹਨੂੰ ਇੱਕ ਟੋਬੇ ਦੇ ਵਿੱਚ ਜਿਹੜਾ ਹੈ ਤੈਰੇ ਆਉਂਦੇ ਸੀਗੇ ਤਾਂ ਉਹ ਇੱਕ ਵੱਖਰਾ ਐਕਸਪੀਰੀਅੰਸ ਸੀਗਾ ਵੀ ਖੁਦ ਉਹ ਚੀਜ਼ ਨੂੰ ਤਿਆਰ ਕਰਨਾ ਆਪਣੇ ਹੱਥੀਂ ਤਿਆਰ ਕਰਨਾ ਬੜਾ ਚਾਅ ਹੁੰਦਾ ਸੀ ਉਹ ਚੀਜ਼ ਦੇ ਲਈ ਅਤੇ ਇੱਕ ਵੱਖਰਾ ਵਧੀਆ ਅਨੁਭਵ ਰਿਹਾ ਇਹ